ਇਹ ਇੱਕ ਬਹੁਤ ਹੀ ਸਰਲ ਪ੍ਰਕਿਰਿਆ ਹੈ ਏ ਟੀ ਐਮ ਕਾਰਡ ਨੂੰ ਮਸ਼ੀਨ ਵਿੱਚ ਪਾਓ ਅਤੇ ਆਪਣੀ ਮਨਪਸੰਦ ਭਾਸ਼ਾ ਦੀ ਚੋਣ ਕਰੋ ਉਸ ਤੋਂ ਬਾਅਦ ਸਕਰੀਨ ਉੱਤੇ ਕੁਛ ਹਦਾਇਤਾਂ ਲਿਖੀਆਂ ਆਉਣ ਗੀਆਂ ਅਤੇ ਉਸ ਦੇ ਨੀਚੇ ਕੁਛ ਆਪਸ਼ਨਾਂ ਵੀ ਹੋਣ ਗਆਂ ਸਾਨੂੰ ਉਹਨਾਂ ਆਪਸ਼ਨਾ ਵਿੱਚੋਂ ਆਪਣੇ ਲੋੜ ਅਨੁਸਾਰ ਚੋਣ ਕਰਕੇ ਅੱਗੇ ਵੱਧਦੇ ਜਾਣਾ ਹੈ ਅਤੇ ਆਪਣੇ ਪਾਸਵਰਡ ਨੂੰ ਸੁਰੱਖਿਅਤ ਰੱਖਣਾ ਹੈ ਕਿ ਕੋਈ ਵੀ ਆਸ ਪਾਸ ਖੜਾ ਵਿਅਕਤੀ ਸਾਡਾ ਪਾਸਵਰਡ ਤਾਂ ਨਹੀਂ ਦੇਖ ਰਿਹਾ